ਖੇਤੀਬਾੜੀ ਪੰਜਾਬ ਦਾ ਮੁੱਖ ਹਿੱਸਾ ਹੈ ਪੰਜਾਬ ਵਿੱਚ ਕਿਸਾਨ ਸਦੀਆਂ ਤੋਂ ਖੇਤੀਬਾੜੀ ਕਰ ਰਹੇ ਹਨ ਜਿਸ ਨਾਲ ਉਹ ਆਪਣਾ ਅਤੇ ਪੂਰੀ ਦੁਨੀਆਂ ਦਾ ਢਿੱਡ ਭਰਦੇ ਹਨ ਮੈਨੂੰ ਵੀ ਖੇਤੀ ਕਰਦੇ ਨੂੰ ਚਾਲ੍ਹੀ ਤੋਂ ਪੰਤਾਲੀ ਸਾਲ ਹੋ ਗਏ ਹਨ ਇਸ ਨਾਲ ਸਾਨੂੰ ਸਾਰਾ ਕੁਝ ਤਾਜਾ ਮਿਲਦਾ ਹੈ ਜਿਵੇਂ ਕਿ ਸਬਜ਼ੀ ਫਲ ਕਣਕ ਚੌਲ ਅਤੇ ਹੋਰ ਬਹੁਤ ਕੁਛ ਇਸ ਕਰਕੇ ਖੇਤੀਬਾੜੀ ਨੂੰ ਦੂਜੇ ਵਿਭਾਗਾਂ ਅਤੇ ਸੈਕਟਰ ਨਾਲ ਜੋੜਿਆ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਕੰਮ ਮਿਲ ਸਕੇ